ਖੁੱਲੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਜੇ ਸਾਨੂੰ ਤੈਰਾਕੀ ਚੰਗੀ ਤਰ੍ਹਾਂ ਨਹੀਂ ਆਉਂਦੀ ਤਾਂ ਸਾਨੂੰ ਕਿਸੇ ਮਾਹਿਰ ਦੀ ਦੇਖ ਰੇਖ ਹੇਠ ਹੀ ਤੈਰਾਕੀ ਕਰਨੀ ਚਾਹੀਦੀ ਹੈ ਉਸ ਤੋਂ ਇਲਾਵਾ ਜਿਹੜੇ ਤੈਰਾਕੀ ਕਰਦੇ ਸਮੇਂ ਲਾਈਫ ਸੇਵਿੰਗ ਇਕਉਪਮੈਂਟ ਜਿੱਦਾਂ ਕਿ ਲਾਈਫ ਸੇਵਿੰਗ ਜੈਕਟ ਹੁੰਦੀ ਹੈ ਤਾਂ ਉਹ ਸਾਨੂੰ ਪਹਿਣ ਕੇ ਹੀ ਤੈਰਾਕੀ ਕਰਨੀ ਚਾਹੀਦੀ ਹੈ